ਹੈਲੋ ਹਾਂਜੀ ਗੁੱਡ ਮੋਰਨਿੰਗ

ਜੀ ਬੁੱਕ ਅਵੇਲੇਬਲ ਹੈ ਆਪਣੇ ਕੋਲ ਵਿਨੋਦ ਦੀ ਹਾਂਜੀ ਲੂਸੈਂਟ ਲੂਸੈਂਟ ਮੀਡੀਅਮ ਕਿਹੜਾ ਚਾਹੀਦਾ ਜੀ ਆਪਾਂ ਨੂੰ ਨਹੀਂ ਇੰਗਲਿਸ਼ ਮੀਡੀਅਮ ਤਾਂ ਜੀ ਮੁਸ਼ਕਲ ਹੈ ਤੁਸੀਂ ਹੋਰ ਕੋਈ ਮੀਡੀਅਮ ਨਹੀਂ ਪ੍ਰੈਫਰ ਕਰ ਸਕਦੇ ਹਾਂ ਤਰੁਣ ਗੋਇਲ ਹੋ ਸਕਦੀ ਹੈ ਲੂਸੈਂਟ ਤਾਂ ਜੀ ਜੋ ਥੋੜ੍ਹੇ ਟਾਈਮ ਪਹਿਲਾਂ ਤੱਕ ਸੀ ਪਰ ਹੋਰ ਹੋਰ ਹੋਰ ਕੋਈ ਕਰਵਾ ਕੇ ਲੈ ਗਿਆ ਤਾਂ ਫਿਲਹਾਲ ਤਾਂ ਅਵੇਲੇਬਲ ਨਹੀਂ ਹੈ ਪਰ ਹੋ ਜਾਵੇਗੀ ਕੁਛ ਦਿਨਾਂ ਤੱਕ ਈਸ਼ੂ ਉਹਨੂੰ ਤਾਂ ਵੈਸੇ ਹਫਤਾ ਹੋ ਗਿਆ ਉਹ ਵੈਸੇ ਦਸ ਕੁ ਦਿਨ ਲਈ ਕਰਵਾ ਕੇ ਲੈ ਗਿਆ ਸੀ ਅਤੇ ਤੁਸੀਂ ਤਿੰਨ ਦਿਨ ਬਾਅਦ ਮਤਲਬ ਈਸ਼ੂ ਕਰਵਾ ਸਕਦੇ ਹੋ ਬੁੱਕ ਲੂਸੈਂਟ ਦੀ ਵੀ ਉਹ ਤਿੰਨ ਦਿਨ ਬਾਅਦ ਦੇ ਕੇ ਜਾਵੇਗਾ ਬੁੱਕ ਹਾਂਜੀ

ਹਾਂਜੀ ਜ਼ਰੂਰ ਤੁਸੀਂ ਤਰੁਣ ਗੋਇਲ ਤਰੁਣ ਗੋਇਲ ਤਾਂ ਆਪਣੇ ਕੋਲ ਅਵੇਲੇਬਲ ਹੈ ਇੰਗਲਿਸ਼ ਮੀਡੀਅਮ 'ਚ ਅਤੇ ਫਿਲਹਾਲ ਲੂਸੈਂਟ ਅਵੇਲੇਵਲ ਹੈ ਆਪਣੇ ਕੋਲ ਹਿੰਦੀ ਮੀਡੀਅਮ 'ਚ ਫਿਜੀਕਲ ਐਜੂਕੇਸ਼ਨ ਆਪਾਂ ਨੂੰ ਕਿਹੜੇ ਔਥਰ ਦੀ ਚਾਹੀਦੀ ਹੈ ਅੱਛਾ ਫਿਜੀਕਲ ਐਜੂਕੇਸ਼ਨ ਵੀ ਵਿਨੋਦ ਦੀ ਚਾਹੀਦੀ ਹੈ ਫਿਜੀਕਲ ਹਾਂ ਬੁਕਸ ਤੁਹਾਨੂੰ ਈਸ਼ੂ ਮਤਲਬ ਤੁਹਾਨੂੰ ਆਪਾਂ ਦਸ ਦਿਨ ਲਈ ਮਿਨੀਮਮ ਸਟਾਰਟਿੰਗ 'ਚ ਦੇ ਸਕਦੇ ਹਾਂ ਹਾਂਜੀ ਦਸ ਦਿਨ ਬਾਅਦ ਤੁਹਾਨੂੰ ਹਾਂਜੀ ਕੋਈ ਨਹੀਂ ਆਪਾਂ ਇਸ਼ੂ ਕਰ ਦੇਵਾਂਗੇ ਤੁਸੀਂ ਆਇਓ

ਨਹੀਂ ਦਸ ਦਿਨ ਦਸ ਦਿਨ ਤੋਂ ਜ਼ਿਆਦਾ ਵੀ ਲੈ ਸਕਦੇ ਹੋ ਉਹ ਸਾਡਾ ਮੈਂਬਰਸ਼ਿਪ ਵੀ ਆ ਜਾਂਦਾ ਹਾਂਜੀ ਫਿਲਹਾਲ ਤੁਸੀਂ ਦਸ ਦਿਨ ਅੱਛਾ ਅੱਛਾ ਫਿਜੀਕਲ ਐਜੂਕੇਸ਼ਨ ਤਰੁਣ ਹਾਂਜੀ ਕੋਈ ਨਹੀਂ ਤੁਸੀਂ ਆ ਜਿਆ ਜੇ ਕਰਵਾ ਲਿਆ ਓਕੇ ਓਕੇ